ਹਾਂ ਇੱਕ ਵਾਰ ਸਾਡੇ ਸਕੂਲ ਵਿੱਚ ਫ਼ੰਕਸ਼ਨ ਹੋਇਆ ਸੀ ਮੈਂ ਉਸ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਮੇਰੇ ਪੇਪਰ ਨਜ਼ਦੀਕ ਆ ਰਹੇ ਸੀ ਅਤੇ ਮੈਂ ਆਪਣਾ ਟਾਈਮ ਸੀ ਜਿਹੜਾ ਉਹ ਪੜ੍ਹਾਈ ਦੇ ਵਿੱਚ ਲਾਉਣਾ ਚਾਹੁੰਦੀ ਸੀ ਫਿਰ ਮੈਂ ਆਪਣੇ ਅਧਿਆਪਕ ਅਤੇ ਆਪਣੀ ਸਹੇਲੀਆਂ ਦੇ ਕਹਿਣ 'ਤੇ ਉਹ ਡਾਂਸ ਵਿੱਚ ਹਿੱਸਾ ਲਿਆ ਅਸੀਂ ਇੱਕ ਗਰੁੱਪ ਡਾਂਸ ਕਰਨਾ ਸੀ ਇਸ ਡਾਂਸ ਦੇ ਅਭਿਆਸ ਲਈ ਸਾਨ ਅਸੀਂ ਇੱਕ ਅਲੱਗ ਰੂਮ ਲੈ ਲਿਆ ਉੱਥੇ ਜਾ ਕੇ ਅਸੀਂ ਹਰ ਰੋਜ਼ ਅਭਿਆਸ ਕਰਦੇ ਸੀ ਅਤੇ ਜਿਸ ਦਿਨ ਸਕੂਲ ਵਿੱਚ ਫ਼ੰਕਸ਼ਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਜਿਹੜੇ ਸਟੈਪ ਨਹੀਂ ਆਉਂਦੇ ਸੀ ਮੈਂ ਉਨ੍ਹਾਂ ਸਟੈਪਾਂ ਦਾ ਦੁਬਾਰਾ ਅਭਿਆਸ ਕੀਤਾ ਅਤੇ ਫ਼ੰਕਸ਼ਨ ਵਾਲੇ ਦਿਨ ਅਸੀਂ ਪ੍ਰਿੰਸੀਪਲ ਮੈਮ ਨੂੰ ਸਟੇਜ ਉੱਤੇ ਬੁਲਾਇਆ ਅਤੇ ਉਨ੍ਹਾਂ ਤੋਂ ਆਪਣਾ ਪ੍ਰੋਗਰਾਮ ਸਟਾਟ ਕਰਨ ਲਈ ਇਜਾਜ਼ਤ ਮੰਗੀ ਫਿਰ ਹਰ ਇਕ ਬੱਚੇ ਨੇ ਆ ਆ ਕੇ ਸਟੇਜ 'ਤੇ ਆਪਣੀ ਪ੍ਰਫੋਰਮੈਂਸ ਦਿਖਾਈ ਜਦੋਂ ਸਾਡੀ ਵਾਰੀ ਸੀ ਮੈਨੂੰ ਬਹੁਤ ਪਹਿਲਾਂ ਪਹਿਲਾਂ ਮੈਨੂੰ ਬਹੁਤ ਘਬਰਾਟ ਮਹਿਸੂਸ ਹੋ ਰਹੀ ਸੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਆਪਣਾ ਡਾਂਸ ਵਧੀਆ ਤਰੀਕੇ ਨਾਲ ਕੀਤਾ ਜਦੋਂ ਸਾਡਾ ਡਾਂਸ ਖ਼ਤਮ ਹੋਇਆ ਤਾਂ ਸਾਰੇ ਟੀਚਰਸ ਅਤੇ ਬੱਚਿਆਂ ਨੇ ਤਾੜੀਆਂ ਮਾਰੀਆਂ ਅਤੇ ਟੀਚਰਸ ਅਤੇ ਬੱਚੇ ਬਹੁਤ ਖੁਸ਼ ਹੋਏ ਇਸ ਉਸ ਤੋਂ ਬਾਅਦ ਸਾਨੂੰ ਸਨਮਾਨਿਤ ਕੀਤਾ ਗਿਆ ਸਾਡੀ ਪਹਿਲੀ ਪੋਜੀਸ਼ਨ ਆਈ ਸੀ ਅਤੇ ਸਾਨੂੰ ਮੈਡਲਾਂ ਨਾਲ ਸਨਮਾਨਿਤ ਕਰਕੇ